ਕਸਬੇ ਦੇ ਮੁਕਾਬਲੇ ਸਾਡੇ ਖੇਤਰ ਵਿੱਚ ਸਿਹਤ ਸੰਭਾਲ ਦੀ ਗੁਣਵੱਤਾ ਬਹੁਤ ਵਧੀਆ ਹੈ ਮੈਂ ਦੱਸਣਾ ਚਾਹੁੰਦਾ ਕਿ ਪਹਿਲੇ ਸਮੇਂ ਨਾਲ਼ੋਂ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਕਾਫ਼ੀ ਪਿੰਡਾਂ ਵਿੱਚ ਵੀ ਸੁਧਾਰ ਕਰ ਦਿੱਤੇ ਨੇ ਅਤੇ ਪਿੰਡਾਂ ਵਿੱਚ ਵੀ ਜਿਸ ਤਰ੍ਹਾਂ ਲੈਬਾਂ ਦੇ ਦਿੱਤੀਆਂ ਨੇ ਲੈਬਾਂ ਆ ਗਈਆਂ ਨੇ ਪਿੰਡਾਂ ਵਿੱਚ ਟੈਸਟ ਕਰਵਾਉਣ ਲਈ ਅਲਟਰਾਸਾਊਂਡ ਮਸ਼ੀਨਾਂ ਨੇ ਜਾਂ ਡਿਸਪੈਂਸਰੀਆਂ ਨੇ ਦਵਾਈਆਂ ਲਈ ਵਧੀਆ ਡਾਕਟਰ ਪਿੰਡਾਂ ਵਾਲਿਆਂ ਨੂੰ ਮੁਹੱਈਆ ਕਰਵਾ ਦਿੱਤੇ ਨੇ ਸੋ ਸਾਡਾ ਤਾਂ ਪਿੰਡ ਵੀ ਜੋ ਹੈ ਸ਼ਹਿਰ ਤੋਂ ਬਹੁਤੀ ਦੂਰ ਨਹੀਂ ਜੇ ਐਮਰਜੈਂਸੀ ਸਾਨੂੰ ਆਪਣੀ ਸਿਹਤ ਸੰਭਾਲ ਕਰਨ ਲਈ ਸ਼ਹਿਰ ਵੀ ਜਾਣਾ ਪੈਂਦਾ ਹੈ ਤਾਂ ਅਸੀਂ ਸ਼ਹਿਰ ਵੀ ਜਾ ਸਕਦੇ ਹਾਂ ਬਾਕੀ ਅਸੀਂ ਸ਼ਹਿਰ ਵਿੱਚ ਪ੍ਰਵਾਸ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਉੱਥੋਂ ਦੇ ਇੱਕ ਸਿਹਤ ਸੰਭਾਲ ਵੱਲ ਵੇਖੀਏ ਤਾਂ ਉੱਥੋਂ ਦਾ ਵਾਤਾਵਰਨ ਨਹੀਂ ਠੀਕ ਰਹਿੰਦਾ ਜਿਸ ਨਾਲ਼ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਜ਼ਿਆਦਾ ਹਾਰਨ ਵੱਜਦੇ ਨੇ ਜ਼ਿਆਦਾ ਨੋਇਸ ਪਲਿਊਸ਼ਨ ਹੋ ਜਾਂਦਾ ਵਾ ਸ਼ੋਰ ਪ੍ਰਦੂਸ਼ਣ ਜਿਹੜਾ ਜ਼ਿਆਦਾ ਹੁੰਦਾ ਵਾ ਹਵਾ ਦਾ ਪ੍ਰਦੂਸ਼ਣ ਜ਼ਿਆਦਾ ਹੁੰਦਾ ਹੈ ਪਿੰਡਾਂ ਵਿੱਚ ਸ ਸ਼ਾਂਤੀ ਹੁੰਦੀ ਹੈ ਅਤੇ ਇੱਥੇ ਵਾਤਾਵਰਨ ਵੀ ਸਾਫ਼ ਅਤੇ ਸੁਥਰਾ ਰਹਿੰਦਾ ਹੈ ਇਸ ਕਰਕੇ ਅਸੀਂ ਪਿੰਡਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਹਾਂ